ਮੈਂ ਨਾ ਇੱਕ ਪ੍ਰੋਡਕਟ ਲਿੱਤਾ ਸੀਗਾ ਉਹ ਸੀਗਾ ਮੈਂ ਐਕਚੂਲੀ ਮੇਰੇ ਨਾ ਵਾਲ ਬੜੇ ਕਰਲੀ ਸੀਗੇ ਅਤੇ ਨਾ ਮੈਂ ਇੱਕ ਮੈਰਿਜ 'ਤੇ ਜਾਣਾ ਸੀਗਾ ਅਤੇ ਸਭ ਨੇ ਸਟਰੇਟ ਕਰਨੇ ਸੀਗੇ ਮੇਰੀ ਕਜ਼ਨ ਸਿਸਟਰਸ ਨੇ ਸਭ ਨੇ ਹੈ ਨਾ ਅਤੇ ਮੈਂ ਇੱਦਾਂ ਸੋਚਿਆ ਕਿ ਮੈਂ ਨਾ ਇੱਕ ਸਟਰੇਟਨਰ ਹੇਅਰ ਸਟਰੇਟਨਰ ਨਾ ਪਰਚੇਜ਼ ਕਰ ਲੈਂਦੀ ਕਿਉਂਕਿ ਲੋੜ ਪੈਂਦੀ ਰਹਿੰਦੀ ਉਸ ਚੀਜ਼ ਦੀ ਅਤੇ ਮੈਂ ਪਰਚੇਜ਼ ਤਾਂ ਕਰ ਲਿਆ ਐਮਾਜ਼ੋਨ ਤੋਂ ਔਰ ਮੈਂ ਨਾ ਫੀਲੀਪਸ ਦਾ ਸੀਗਾ ਔਰ ਮੈਨੂੰ ਪਤਾ ਕਿ ਫੀਲੀਪਸ ਦੇ ਸਾਰੇ ਜਿਹੜੇ ਜਿੰਨੇ ਵੀ ਅਸੀਂ ਇਲੈਕਟ੍ਰੋਨਿਕ ਜਿਹੜੀ ਚੀਜ਼ਾਂ ਲੈਂਦੇ ਆ ਉਹ ਵਧੀਆ ਹੁੰਦੀਆਂ ਅਤੇ ਉਹ ਕਾਫੀ ਮਹਿੰਗਾ ਸੀਗਾ ਹੈ ਨਾ ਪਰ ਫਿਰ ਵੀ ਅਸੀਂ ਥੋੜ੍ਹੇ ਬਹੁਤੇ ਪੈਸੇ ਇਕੱਠੇ ਕਰਕੇ ਨਾਲੇ ਜ਼ਿਆਦਤਰ ਤਾਂ ਮੈਂ ਹੀ ਪਾਏ ਸੀਗੇ ਅਤੇ ਉਹ ਫਿਰ ਪੈਸੇ ਇਕੱਠੇ ਕਰਕੇ ਫਿਰ ਅਸੀਂ ਇੱਕ ਲੈ ਲਿਆ ਕਿ ਚਲੋ ਸਾਰੇ ਜਿਹਨਾਂ ਨੇ ਵੀ ਕਰਨੇ ਹੋਊਗੇ ਤਾਂ ਆਪਣਾ ਸਟਰੇਟ ਕਰ ਸਕਦੇ ਈਜ਼ੀਲੀ ਹੈ ਨਾ ਚਲੋ ਦਸ ਦਿਨ ਪਹਿਲਾਂ ਮੈਰਿਜ ਤੋਂ ਦਸ ਦਿਨ ਪਹਿਲਾਂ ਮੇਰੇ ਕੋਲ ਤਾਂ ਉਹ ਆ ਗਿਆ ਸੀਗਾ ਸਟੇਨਰ ਮੈਂ ਬੜੀ ਖੁਸ਼ ਹੋਈ ਕਿ ਹਾਏ ਵਧੀਆ ਹੋਵੇਗਾ ਔਰ ਕਲਰ ਵੀ ਮੈਂ ਪਿੰਕ ਲੀਤਾ ਮੈਨੂੰ ਪਸੰਦ ਸੀਗਾ ਜੋ ਹੈ ਨਾ ਅਤੇ ਫਿਰ ਮੈਂ ਉਹਦੇ ਵਿੱਚ ਜਦੋਂ ਮੈਂ ਖੋਲ੍ਹਿਆ ਮੈਨੂੰ ਵਧੀਆ ਲੱਗਿਆ ਅਤੇ ਮੈਂ ਜਦੋਂ ਹੀ ਪਲੱਗ ਕਰਨ ਲੱਗੀ ਨਾ ਅਤੇ ਉਹ ਨਾ ਸ਼ੋਰਟ ਸਰਕਟ ਹੋ ਗਿਆ ਅਤੇ ਮੈਨੂੰ ਇੱਕਦਮ ਮੇਰੇ ਵੀ ਕਰੰਟ ਲੱਗਿਆ ਹੈ ਨਾ ਅਤੇ ਮੈਂ ਡਰ ਗਈ ਅਤੇ ਉਹ ਜਿਹੜੀ ਪੂਰੀ ਵਾਇਰ ਸੀਗੀ ਉਹ ਖਰਾਬ ਹੋ ਗਈ ਜਦੋਂ ਫਿਰ ਉਹ ਮੈਂ ਦੁਬਾਰਾ ਉਹਨਾਂ ਨੂੰ ਕਿਹਾ ਕਿ ਇੱਦਾਂ ਦਾ ਇਹ ਪ੍ਰੋਡਕਟ ਅੱਛਾ ਨਹੀਂ ਰਿਹਾ ਤੁਹਾਡਾ ਹੈ ਨਾ ਅਤੇ ਉਹਨਾਂ ਨੇ ਮੇਰਾ ਕੋਈ ਰਿਸਪੋਂਸ ਨਹੀਂ ਦਿੱਤਾ ਔਰ ਮੈਂ ਦੱਸਿਆ ਉਹਨਾਂ ਨੂੰ ਕਿ ਇੰਨਾਂ ਮਹਿੰਗਾ ਸੀਗਾ ਮੈਂ ਮੇਰੇ ਬਜਟ ਦੇ ਵਿੱਚ ਵੀ ਨਹੀਂ ਸੀਗਾ ਫਿਰ ਵੀ ਮੈਂ ਉਹ ਪਰਚੇਜ਼ ਕੀਤਾ ਔਰ ਮੇਰਾ ਦੂਜੀ ਗੱਲ ਮੇਰਾ ਮੈਰਿਜ 'ਤੇ ਜਾਣ ਲਈ ਮੈਂ ਉਹ ਪਰਚੇਜ਼ ਕੀਤਾ ਸੀਗਾ ਮੈਂ ਉਹਦੇ ਵਿੱਚ ਵੀ ਨਹੀਂ ਉਹ ਆਪਣਾ ਯੂਜ਼ ਕਰ ਪਾਈ ਹੈ ਨਾ ਮੇਰੇ ਸਾਰੇ ਕਜ਼ਨਸ ਬੜੇ ਡਿਸਅਪੁਆਇੰਟ ਹੋਏ ਕਿ ਨਹੀਂ ਇਹ ਵਧੀਆ ਪ੍ਰੋਡਕਟ ਨਹੀਂ ਸੀਗਾ ਔਰ ਇੱਥੋਂ ਤੋਂ ਆਪਾਂ ਕਦੇ ਵੀ ਚੀਜ਼ਾਂ ਪਰਚੇਜ਼ ਨਹੀਂ ਕਰਨੀਆਂ ਹੈਗੀਆਂ ਅਤੇ ਮੈਨੂੰ ਇਹ ਲੱਗਿਆ ਕਿ ਇਹ ਵਾਲਾ ਸਭ ਤੋਂ ਘਟੀਆ ਮੇਰਾ ਐਕਪੀਰੀਐਂਨਸ ਰਿਹਾ ਕਿ ਜਦੋਂ ਮੈਂ ਇਹ ਹੇਅਰ ਸਟਰੇਟਨਰ ਪਰਚੇਜ਼ ਕੀਤਾ ਔਰ ਇੰਨਾਂ ਮਹਿੰਗਾ ਕੀਤਾ ਅਤੇ ਉਹ ਮੇਰੇ ਕੋਈ ਕੰਮ ਵੀ ਨਹੀਂ ਆਇਆ ਹੈਗਾ